ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਸਵਿੰਗ ਕੈਫੇ ਤੋਂ ਬੋਲਦੇ ਜੇ ਸਰ ਇਸ ਕੈਫੇ ਤੋਂ ਮੈਂ ਆਪਣੇ ਲਈ ਭੋਜਨ ਮੰਗਵਾ ਔਡਰ ਕੀਤਾ ਸੀ ਸਰ ਹੁਣ ਮੈਂ ਤੁਹਾਨੂੰ ਇਸ ਔਡਰ ਕੀਤੇ ਹੋਏ ਭੋਜਨ ਬਾਰੇ ਹੀ ਪਤ ਹੀ ਗੱਲ ਕਰਨੀ ਸੀ ਮੈਂ ਆਪਣਾ ਜਿਹੜੇ ਐਡਰੈੱਸ 'ਤੇ ਭੋਜਨ ਮੰਗਵਾਉਣਾ ਸੀ ਉਹ ਮੈਂ ਐਡਰੈੱਸ ਚੇਂਜ ਕਰਕੇ ਦੁਬਾਰਾ ਦੱਸਣਾ ਸੀ ਵੀ ਮੈਂ ਆਪਣਾ ਐਡਰੈੱਸ ਚੇਂਜ ਕਰ ਲਿਆ ਹੋਇਆ ਵਾ ਕਿਰਪਾ ਕਰਕੇ ਤੁਸੀਂ ਮੈਨੂੰ ਉਸੇ ਹੀ ਐਡਰੈੱਸ 'ਤੇ ਮੇਰਾ ਭੋਜਨ ਪਹੁੰਚਾ ਸਕਦੇ ਹੋ ਇਸ ਲਈ ਹੀ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਵੀ ਮੈਨੂੰ ਮੈਂ ਪਿੰਡ ਢੰਡ ਮੰਨਣਾਵਾਲਾ ਰੋਡ ਕਲਰਾਂ ਵਾਲੇ ਭੱਠੇ ਦੇ ਨੇੜੇ ਆਪਣਾ ਘਰ ਲੈ ਲਿਆ ਹੋਇਆ ਵਾ ਉਹਦਾ ਮਕਾਨ ਨੰਬਰ ਇੱਕ ਸੌ ਤੇਈ ਨੰਬਰ ਹੈ ਪਲੀ ਕਿਰਪਾ ਕਰਕੇ ਤੁਸੀਂ ਮੇਰਾ ਭੋਜਨ ਉੱਥੇ ਹੀ ਉਸ ਉਸ ਐਡਰੈੱਸ 'ਤੇ ਕੀ ਕਿਰਪਾ ਕਰਕੇ ਭੇਜ ਦਓ ਅਤੇ ਇਸੇ ਬਾਰੇ ਹੀ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਸਰ ਫਿਰ ਤੁਹਾਡੇ ਤੋਂ ਗੱਲ ਕਰਨੀ ਹੈ ਉਸੇ ਬਾਰੇ ਹੀ ਗੱਲ ਕਰਨੀ ਵੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਜੇ ਤੁਸੀਂ ਨਾ ਉਸੇ ਹੀ ਪਤੇ 'ਤੇ ਮੇਰਾ ਖਾ ਭੋਜਨ ਭੇਜ ਦਓ ਤਾਂ